ਹਰੇਕ ਬੰਦੇ ਦੀ ਲਾਈਫ 'ਚ ਨਾ ਕੋਈ ਨਾ ਕੋਈ ਇਹੋ ਜਿਹਾ ਬੰਦਾ ਜ਼ਰੂਰ ਹੁੰਦਾ ਜਿਹਦੇ ਨਾਲ ਉਹ ਹਰੇਕ ਆਪਣੇ ਮਤਲਬ ਦਿਲ ਦੀ ਗੱਲ ਜਾਂ ਉਹਨੂੰ ਕੋਈ ਦਿੱਕਤ ਆਉਂਦੀ ਆ ਉਹ ਬੰਦਾ ਉਹਦੇ ਨਾਲ ਸ਼ੇਅਰ ਕਰਦਾ ਏ ਅਤੇ ਐਵੇਂ ਮੇਰੀ ਲਾਈਫ 'ਚ ਵੀ ਇੱਕ ਹੈਗਾ ਬੰਦਾ ਅਤੇ ਉਹ ਮੇਰੇ ਨਾਲ ਬਚਪਨ ਤੋਂ ਹੀ ਅਸੀਂ ਇਕੱਠੇ ਹੀ ਪੜ੍ਹੇ ਹਾਂ ਅਤੇ ਉਹਨੇ ਵੈਸੇ ਆਪਣਾ ਮਿਊਜਿਕ ਦੀ ਇਹਦੇ 'ਚ ਆਪਣੀ ਪੀ ਐੱਚ ਡੀ ਓ ਕਰੀ ਹੋਈ ਆ ਇੱਕ ਤਰ੍ਹਾਂ ਅਤੇ ਮੈਂ ਤਾਂ ਫਿਲਹਾਲ ਨਹੀਂ ਕੀਤੀ ਮੈਂ ਤਾਂ ਵੈਸੇ ਹੀ ਇੱਕ ਸ਼ੌਂਕ ਦੇ ਤੌਰ 'ਤੇ ਲਿਖਣ ਲੱਗ ਗਿਆ ਅਤੇ ਉਹ ਬੰਦੇ ਨੂੰ ਪੂਰੀ ਜਾਣਕਾਰੀ ਹੈ ਅਤੇ ਉਹ ਬੰਦਾ ਆਪਣਾ ਜਿਹੜਾ ਹੁਣ ਵੋਇਸ ਪੰਜਾਬ ਹੋਇਆ ਉਹਦੇ 'ਚ ਜੱਜ ਬਣ ਕੇ ਵੀ ਆਇਆ ਅਤੇ ਉਹਦੀ ਲਿਖਤ ਬਾਕਈ ਬਹੁਤ ਸੋਹਣੀ ਆ ਅਤੇ ਮੈਨੂੰ ਜਦ ਮੈਨੂੰ ਕੋਈ ਵੀ ਦਿੱਕਤ ਆਉਂਦੀ ਆ ਜਾਂ ਮੈਨੂੰ ਕੋਈ ਵੀ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਮੈਂ ਉਹਨੂੰ ਹੀ ਫੋਨ ਕਰਦਾ ਅਤੇ ਉਹ ਮੇਰੀ ਪ੍ਰੋਬਲਮ ਨੂੰ ਸਮਝਦਾ ਵੀ ਆ ਅਤੇ ਉਹਦਾ ਕੋਈ ਨਾ ਕੋਈ ਹੱਲ ਉਹਦੇ ਕੋਲ ਹੁੰਦਾ ਹੀ ਹੁੰਦਾ ਵੀ ਹਾਂ ਇਹ ਚੀਜ਼ ਐਵੇਂ ਨਹੀਂ ਐਵੇਂ ਹੋਵੇਗੀ ਅਤੇ ਉਹਦੇ ਨਾਲ ਇਹ ਗੱਲ ਕਰਦਾ ਮੈਂ ਹੋਰ ਕਿਸੇ ਨਾਲ ਨਹੀਂ ਗੱਲ ਕਰਦਾ ਅਤੇ ਬਾਕੀ ਉਹਦੇ ਨਾਲ ਮਿਲ ਕੇ ਜਦੋਂ ਬੈਠਦੇ ਹਾਂ ਉਹਦੇ ਕੋਲੋਂ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਉਹਦੇ ਕੋਲੋਂ ਵੀ ਇੱਕ ਕੁਛ ਨਾ ਕੁਛ ਨਵਾਂ ਹਰੇਕ ਜਦ ਵੀ ਉਹਦੇ ਨਾਲ ਬੈਠੇ ਹਾਂ ਜਦ ਵੀ ਗੱਲ ਹੋਈ ਆ ਅਤੇ ਉਹਦੇ ਨਾਲ ਸਿੱਖਣ ਨੂੰ ਮੈਨੂੰ ਕੁਛ ਨਾ ਕੁਛ ਨਵਾਂ ਮਿਲਿਆ ਹੀ ਮਿਲਿਆ